ਦੇਖੋ ਯੋਗਾ ਦੀ ਸ਼ੁਰੂਆਤ ਕਰਨ ਲਈ ਕੋਈ ਕੋਈ ਨਿਰਧਾਰਤ ਉਮਰ ਨਹੀਂ ਹੁੰਦੀ ਪਰ ਇਹ ਵੱਖ ਵੱਖ ਉਮਰਾਂ ਵਿੱਚ ਵੀ ਵੱਖ ਵੱਖ ਤਰੀਕਿਆਂ ਨਾਲ ਲਾਭਦਾਇਕ ਹੁੰਦਾ ਹੈ ਇਹ ਸਰੀਰਕ ਮਾਨਸਿਕ ਅਤੇ ਆਤਮਿਕ ਤੰਦਰੁਸਤੀ ਨੂੰ ਸੁਧਾਰਨ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਯੋਗਾ ਦੇ ਆਧੁਨਿਕ ਅਧਿਅਨ ਅਤੇ ਪਰਚੀਨ ਗ੍ਰੰਥਾਂ ਵਿੱਚੋਂ ਹੇ ਪਤਾ ਲੱਗਦਾ ਹੈ ਕੀ ਕਿਸੇ ਵੀ ਉਮਰ ਵਿੱਚ ਜੋਗਾ ਸ਼ੁਰੂ ਕੀਤਾ ਜਾ ਸਕਦਾ ਹੈ ਪਰ ਵੱਖ ਵੱਖ ਉਮਰਾਂ ਲਈ ਵੱਖ ਵੱਖ ਪੱਧਰ ਦੇ ਆਸਨ ਪੁਰਾਣੇਅਮ ਅਤੇ ਧਿਆਨ ਦੀਆਂ ਵਿਧੀਆਂ ਨਾਲ ਵਿਧੀਆਂ ਲਾਗੂ ਹੁੰਦੀਆਂ ਹਨ ਬੱਚਿਆਂ ਲਈ ਪੰਜ ਛੇ ਸਾਲ ਦੀ ਉਮਰ ਤੋਂ ਹੀ ਯੋਗਾ ਸ਼ੁਰੂ ਕਰਵਾ ਦੇਣਾ ਚਾਹੀਦਾ ਇਹ ਬਹੁਤ ਹੀ ਲਾਭਕਾਰੀ ਹੁੰਦਾ ਹੈ ਇਸ ਉਮਰ ਵਿੱਚ ਉਹਨਾਂ ਦੀ ਲਚਕਤਾ ਬਹੁਤ ਹੀ ਵਧੀਆ ਹੁੰਦੀ ਹੈ ਜਿਸ ਕਾਰਨ ਉਹ ਸੌਖੇ ਤਰੀਕੇ ਨਾਲ ਵੱਖ ਵੱਖ ਆਸਨ ਕਰ ਸਕਦੇ ਹਨ ਬੱਚਿਆਂ ਲਈ ਜੋਗਾ ਉਹਨਾਂ ਦੀ ਇਕਾਗਰਤਾ ਨੂੰ ਵਧਾਉਂਦਾ ਹੈ ਸਰੀਰਕ ਵਿਕਾਸ ਵਿੱਚ ਬਹੁਤ ਹੀ ਮਦਦ ਕਰਦਾ ਹੈ ਅਤੇ ਉਹਨਾਂ ਦੀ ਰਚਨਾਤਨਾਂ ਵਿੱਚ ਵੀ ਸੁਧਾਰ ਕਰਦਾ ਹੈ ਸ਼ੁਰੂਆਤ ਵਿੱਚ ਤੜ ਆਸਨ ਬੁਝੰਗ ਆਸਨ ਬਾਲ ਆਸਨ ਅਤੇ ਸਖਤ ਆਸਨ ਵਰਗੀਆਂ ਸੌਖੀਆਂ ਕੁਸਦਾਂ ਬੀ ਉੱਤਮ ਰਹਿੰਦੀਆਂ ਹਨ ਅਤੇ ਪੰਦਰਾਂ ਵੀਹ ਸਾਲ ਦੀ ਉਮਰ ਵਾਲੇ ਵਿਅਕਤੀਆਂ ਲਈ ਜੋਗਾ ਸਰੀਰ ਦੀ ਤਾਕਤ ਸਹਿਣਸ਼ੀਲਤਾ ਅਤੇ ਫੁਰਤੀ ਨੂੰ ਵਧਾਉਣ ਵਿੱਚ ਬਹੁਤ ਹੀ ਮਦਦ ਕਰਦਾ ਹੈ ਇਸ ਉਮਰ ਵਿੱਚ ਵਿਅਕਤੀ ਜਿਆਦਾ ਸ਼ਰੀਰਿਕ ਤੌਰ ਤੇ ਸਰਗਰਮ ਹੁੰਦੇ ਹਨ ਇਸ ਲਈ ਉਹਨਾਂ ਲਈ ਹਠ ਯੋਗ ਯੋਗ ਅਤੇ ਬਿਆਮਕ ਆਸਨ ਵਧੀਆ ਹੁੰਦੇ ਹਨ ਇਹ ਆਸਨ ਮਾਸਪੇਸ਼ੀਆਂ ਨੂੰ ਮਜਬੂਤ ਬਣਾਉਂਦੇ ਹਨ ਜੋੜਾਂ ਦੀ ਚੁਸਤਾ ਵਧਾਉਂਦੇ ਹਨ ਅਤੇ ਮਨ ਵਿੱਚ ਠਹਿਰਾ ਲਿਆਂਦੇ ਹਨ ਤੀਹ ਤੋਂ ਪੰਜਾਹ ਸਾਲ ਦੀ ਉਮਰ ਵਿੱਚ ਜਿਆਦਾਤਰ ਲੋਕ ਆਪਣੇ ਪੇਸ਼ੇਵਰ ਜੀਵਨ ਪਰਿਵਾਰਕ ਜਿੰਮੇਵਾਰੀਆਂ ਅਤੇ ਉਹਨਾਂ ਦੇ ਕਾਰਨ ਦਬਾਅ ਵਿੱਚ ਰਹਿੰਦੇ ਹਨ ਇਸ ਉਮਰ ਵਿੱਚ ਯੋਗਾ ਮਾਨਸਿਕ ਸੰਤੁਲਨ ਬਣਾਏ ਰੱਖਣ ਲਈ ਅਤੇ ਭਾਰ ਘਟਾਉਣ ਲਈ ਸਰੀਰ ਨੂੰ ਤੰਦਰੁਸਤ ਰੱਖਣ ਲਈ ਬਹੁਤ ਹੀ ਮਦਦ ਕਰਦਾ ਹੈ ਇਸ ਉਮਰ ਦੇ ਵਿਅਕਤੀਆਂ ਲਈ ਭ੍ਰਾਮਰੀ ਪਰਾਆਨਾਮ ਅਲੋਮ ਵਲੋਮ ਉੱਤਮ ਆਸਨ ਅਤੇ ਉਪਯੋਗੀ ਹੁੰਦੇ ਹਨ ਜੋ ਦਿਲ ਮਗਜ ਅਤੇ ਹੱਡੀ ਨੂੰ ਤਾਕਤ ਵਧਾਉਂਦੇ ਹਨ